ਪਿੰਜਰੇ ਵਿੱਚ ਕੈਦ ਪੰਛੀਆਂ ਨੂੰ ਵੇਖ ਕੇ ਮੇਰਾ ਬਹੁਤ ਦਿਮਾਗ ਖ਼ਰਾਬ ਹੁੰਦਾ ਹੈ ਸਾਡੇ ਕੋਲ ਇੱਕ ਕਬੂਤਰ ਸੀ ਰਾਤ ਨੂੰ ਆਪਾਂ ਸੌਣ ਵੇਲੇ ਉਸਨੂੰ ਪਿੰਜਰੇ ਵਿੱਚੋਂ ਕੱਢ ਦਿੰਦੇ ਸੀ ਇੱਕ ਦਿਨ ਆਪਾਂ ਉਸਨੂੰ ਆਜ਼ਾਦ ਛੱਡ ਕੇ ਆਰਾਮ ਨਾਲ ਸੌਂ ਗਏ ਜਦੋਂ ਸਵੇਰੇ ਉੱਠ ਕੇ ਉਸਨੂੰ ਦੇਖਿਆ ਤਾਂ ਸਾਡਾ ਬਹੁਤ ਹੀ ਦਿਮਾਗ ਖ਼ਰਾਬ ਹੋਇਆ ਕਿਉਂਕਿ ਉਸ ਨੂੰ ਇੱਕ ਬਿੱਲੀ ਖਾ ਚੁੱਕੀ ਸੀ ਜਦੋਂ ਉੱਠ ਕੇ ਅਸੀਂ ਕਬੂਤਰ ਨੂੰ ਵੇਖਿਆ ਤਾਂ ਕਬੂਤਰ 'ਤੇ ਸਿਰਫ਼ ਪੰਖ ਹੀ ਸਾਡੇ ਕਮਰੇ ਵਿੱਚ ਪਏ ਹੋਏ ਆਪਾਂ ਦੇਖੇ ਉਹ ਵੇਖ ਕੇ ਅਸੀਂ ਬਹੁਤ ਰੋਏ ਇਸ ਲਈ ਮੇਰਾ ਤਾਂ ਖਿਆਲ ਇਹ ਹੀ ਹੈ ਕਿ ਸਾਨੂੰ ਪਿੰਜਰੇ ਵਿੱਚ ਬੰਦ ਪੰਛੀ ਨਹੀਂ ਰੱਖਣੇ ਚਾਹੀਦੇ ਜਦੋਂ ਅਸੀਂ ਉਹਨਾਂ ਨੂੰ ਬੰਨ ਰੱਖਦੇ ਹਾਂ ਤਾਂ ਉਹ ਸਾਨੂੰ ਬਦਦੁਆਵਾਂ ਵੀ ਦਿੰਦੇ ਹਨ ਕਿਸੇ ਨੂੰ ਕੈਦ ਕਰਨਾ ਵਧੀਆ ਗੱਲ ਨਹੀਂ ਹੈ ਇਸ ਲਈ ਪੰਛੀ ਰੱਖਣੇ ਹੀ ਨਹੀਂ ਚਾਹੀਦੇ ਜਦੋਂ ਉਹ ਮਰ ਜਾਣ ਤਾਂ ਬਹੁਤ ਹੀ ਦੁੱਖ ਹੁੰਦਾ ਹੈ